ਹੈਲੋ ਸਤਿ ਸ਼੍ਰੀ ਆਕਾਲ ਜੀ ਮੈਂ ਆਂਚਲ ਨਾਲ ਗੱਲ ਕਰ ਰਿਹਾ ਜੀ ਮੈਂ ਦਾਨਿਸ਼ ਭੱਟੀ ਬੋਲ ਰਿਹਾ ਸੀਗਾ ਜੀ ਮੈਂ ਇੱਕ ਬਲੋਗਰ ਹਾਂ ਮੇਰਾ ਯੂਟੀਊਬ ਚੈਨਲ ਵੀ ਹੈ ਫੁਡੀ ਦਾਨਿਸ਼ ਹਾਂਜੀ ਹਾਂਜੀ ਮੈਂ ਇੱਕ ਰਿਸਰਚ ਕਰ ਰਿਹਾ ਸੀ ਵੀ ਆਪਣੇ ਏਰੀਏ ਵਿੱਚ ਜੋ ਫੇਮਸ ਫੂਡ ਸ਼ੋਪਸ ਨੇ ਉਹਨਾਂ 'ਤੇ ਰਿਸਰਚ ਕਰ ਰਿਹਾ ਵੀ ਵੀ ਆਪਣੇ ਏਰੀਏ 'ਚ ਕਿਹੜੀਆਂ ਫੂਡ ਸ਼ੋਪ ਆ ਜਿਹੜੀ ਤੁਹਾਨੂੰ ਵਧੀਆ ਲੱਗਦਾ ਕੀ ਕੀ ਆਇਟਮ ਉੱਥੇ ਤੁਹਾਨੂੰ ਖਾਣ ਨੂੰ ਪਸੰਦ ਆ ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦੇ ਸਕਦੇ ਹੋ ਔਰ ਵੀ ਇੰਡੀਅਨ ਫੂਡਸ ਇੰਡੀਅਨ ਫੂਡ ਹੋ ਗਿਆ ਸਾਊਥ ਇੰਡੀਅਨ ਫੂਡ ਹੋ ਗਿਆ ਜਾਂ ਆਪਣਾ ਚਾਈਨੀਜ਼ ਹੋ ਗਿਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫੂਡ ਜਿਹਦੇ ਹਾਂਜੀ ਫਾਸਟ ਫੂਡ ਵਗੈਰਾ ਲੈ ਲਓ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੀ ਫੇਮਸ ਸ਼ੋਪ ਹੈ ਵੀ ਜਿਹੜੀ ਜਿੱਥੇ ਜਾਣਾ ਤੁਹਾਨੂੰ ਤਾਂ ਇਹ ਹਮੇਸ਼ਾ ਪਸੰਦ ਹੈ ਤੁਸੀਂ ਉੱਥੇ ਜ਼ਰੂਰ ਜਾਂਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਜੀ ਜੀ ਜੀ ਜੀ ਜੀ ਜੇ ਕੋਈ ਫਾਸਟ ਫੂਡ ਤੋਂ ਇਲਾਵਾ ਮੈਨ ਕੋਰਸ ਦੀ ਗੱਲ ਕਰੀਏ ਜਿਵੇਂ ਕੇ ਆਪਾਂ ਡੇਲੀ ਰੁਟੀਨ ਵਿਚ ਕੋਈ ਸਬਜ਼ੀ ਵੈਗੈਰਾ ਖਾਂਦੇ ਹਾਂ ਉਸ ਉਹਦੇ ਲਈ ਤੁਸੀਂ ਕਿਹੜਾ ਰੈਸਟੋਰੈਂਟ ਜਾਣਾ ਪ੍ਰੋਫੈ ਪ੍ਰੈਫਰ ਕਰੋਗੇ ਜੀ ਓਕੇ ਓਕੇ ਜੀ ਜੀ ਅੱਛਾ ਜੀ ਅਤੇ ਸਵੀਟ ਡਿਸ਼ ਲਈ ਕੋਈ ਫੇਮਸ ਆਪਣਾ ਸ਼ੋਪ ਵਗੈਰਾ ਜਿਵੇ ਆਇਸ ਕਰੀਮ ਆਇਸ ਕਰੀਮ ਪਾਰਲਰ ਆਇਸ ਕਰੀਮ ਪਾਰਲਰ ਜੀ ਜੀ ਠੀਕ ਹੈ ਮੈਮ ਓਕੇ ਮੈਮ ਧੰਨ ਧੰਨਵਾਦ ਜੀ ਤੁਹਾਡਾ ਕੀਮਤੀ ਸਮਾਂ ਦੇਣ ਲਈ ਜੀ ਧੰਨਵਾਦ